ਭੰਗੜਾ ਪੰਜਾਬ ਦਾ ਫੋਕ ਡਾਂਸ ਹੈ ਜੋ ਕਿ ਬੱਚੇ ਬਹੁਤ ਇੰਜੋਏ ਨਾਲ ਕਰਦੇ ਹਨ ਇਹ ਭੰਗੜਾ ਸਾਡੇ ਪੰਜਾਬ ਦੇ ਸਾਰੇ ਸਕੂਲਾਂ ਕਾਲਜਾਂ ਵਿੱਚ ਬੱਚਿਆਂ ਤੋਂ ਕਰਵਾਇਆ ਜਾਂਦਾ ਹੈ ਇਹ ਸਾਡੇ ਯੂਨੀਵਰਸਿਟੀ ਬੋਰਡਾਂ ਅਤੇ ਸਕੂਲਾਂ ਦੇ ਵਿੱਚ ਇਹਨਾਂ ਦੇ ਕੰਪਟੀਸ਼ਨ ਵੀ ਕਰਵਾਏ ਜਾਂਦੇ ਹਨ ਇਸ ਵਿੱਚ ਵੱਖ ਵੱਖ ਸਕੂਲਾਂ ਦੇ ਬੱਚੇ ਪਾਰਟ ਲੈਂਦੇ ਹਨ ਭੰਗੜਾ ਕੰਪੀਟੀਸ਼ਨ ਦਾ ਵਿੱਚ ਦਸ ਮਿੰਟ ਦਾ ਸਮਾਂ ਹਰ ਕੰਪੀਟੀਟਰ ਨੂੰ ਦਿੱਤਾ ਜਾਂਦਾ ਹੈ ਜਿਸ ਵਿੱਚ ਉਹਨਾਂ ਨੇ ਆਪਣੇ ਭੰਗੜੇ ਦੇ ਵਧੀਆ ਵਧੀਆ ਸਟੈਪ ਕਰਕੇ ਜੱਜਸ ਨੂੰ ਖੁਸ਼ ਕਰਨਾ ਹੁੰਦਾ ਹੈ ਇਹਦੇ ਵਿੱਚ ਕਾਫ਼ੀ ਤਰ੍ਹਾਂ ਦੇ ਇੰਸਟੂਮੈਂਟ ਵੀ ਯੂਜ਼ ਕੀਤੇ ਜਾਂਦੇ ਨੇ ਜਿਹਦੇ ਵਿੱਚ ਝੂਮਰ ਲੁੱਡੀ ਧਮਾਲ ਸਿਆਲਕੋਟ ਸੱਪ ਖੂੰਡੇ ਮਿਰਜਾ ਕਈ ਤਰ੍ਹਾਂ ਦੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ ਜਿਸ ਦੇ ਵਿੱਚ ਬੱਚੇ ਬਹੁਤ ਤੰਦਰੁਸਤੀ ਦੇ ਨਾਲ ਅਤੇ ਖੁਸ਼ ਹੋ ਕੇ ਭੰਗੜਾ ਪਾਇਆ ਜਾਂਦਾ ਹੈ ਜਿਸ ਦੇ ਵਿੱਚ ਬੱਚਿਆਂ ਦੀ ਕਾਫ਼ੀ ਤੰਦਰੁਸਤੀ ਵੀ ਔਰ ਕਾਫੀਫਿਟਨੈਸ ਦੇਖੀ ਜਾਂਦੀ ਹੈ ਇਸ ਦੇ ਵਿੱਚ ਬੱਚਿਆਂ ਨੂੰ ਅੱਠ ਤੋਂ ਦਸ ਮਿੰਟ ਆਪਣਾ ਸਮਾਂ ਪਰਫੋਮ ਕਰਨਾ ਪੈਂਦਾ ਹੈ